ਸਾਡੇ ਖੇਤਰ ਦੇ ਵਿੱਚ ਕਈ ਤਰ੍ਹਾਂ ਦੇ ਪੰਛੀ ਪਾਏ ਜਾਂਦੇ ਹਨ ਜਿਵੇਂ ਕੀ ਕਾਂ ਚਿੜੀਆਂ ਇੱਲਾਂ ਬਗਲੇ ਆਦੀ ਪਰ ਅੱਜ ਕੱਲ ਅਸੀਂ ਦੇਖਦੇ ਹਾਂ ਕੀ ਇਹ ਬਹੁਤ ਹੀ ਘੱਟ ਦਿਖਦੇ ਹਨ ਇਸ ਲਈ ਇਹਨਾਂ ਨੂੰ ਦੇਖਣ ਲਈ ਪਿੰਡ ਜਾਂ ਕਿਸੇ ਚਿੜੀਆ ਘਰ ਦੇ ਵਿੱਚ ਜਾਣਾ ਪੈਂਦਾ ਹੈ ਇੱਕ ਵਾਰ ਮੈਂ ਪਿੰਡ ਗਈ ਉੱਥੇ ਮੈਂ ਕਈ ਤਰ੍ਹਾਂ ਦੇ ਪੰਛੀ ਦੇਖੇ ਇਹ ਓ ਉਸ ਉਹਨਾਂ ਸਾਰੇ ਪੰਛੀਆਂ ਦੇ ਵਿੱਚੋਂ ਮੈਨੂੰ ਚਿੜੀ ਸਭ ਤੋਂ ਵਧੀਆ ਲੱਗੀ ਉਹ ਬਹੁਤ ਹੀ ਪਿਆਰੀ ਅਤੇ ਨਿੱਕੀ ਜਿਹੀ ਸੀ ਉਸਦਾ ਰੰਗ ਬਹੁਤ ਹੀ ਸੋਹਣਾ ਸੀ ਉਸ ਤੋਂ ਬਾਅਦ ਮੈਂ ਇੱਕ ਚਿੜੀਆਘਰ ਦੇ ਵਿੱਚ ਗਈ ਉਸ ਵਿੱਚ ਵੀ ਮੈਂ ਕਈ ਤਰ੍ਹਾਂ ਦੇ ਪੰਛੀ ਦੇਖੇ ਜਿਸ ਵਿੱਚੋਂ ਮੈਨੂੰ ਮੋਰ ਸਭ ਤੋਂ ਵਧੀਆ ਲੱਗਾ ਕਿਉਂਕਿ ਇੱਕ ਤਾਂ ਉਹ ਸਾਡਾ ਰਾਸ਼ਟਰੀ ਪੰਛੀ ਹੈ ਇਸ ਦੇ ਨਾਲ ਉਸ ਦਾ ਰੰਗ ਬਿਰੰਗੇ ਖੰਭ ਮੈਨੂੰ ਬਹੁਤ ਜਿਆਦਾ ਵਧੀਆ ਲੱਗੇ ਜਦੋਂ ਮੋਰ ਬੱਦਲਾਂ ਨੂੰ ਦੇਖਦਾ ਹੈ ਤਾਂ ਉਹ ਆਪਣੇ ਖੰਭ ਖਿਲਾਰ ਕੇ ਪੈਲਾਂ ਪਾਉਣ ਲੱਗਦਾ ਹੈ ਉਹ ਆਪਣੇ ਖੰਭਾਂ ਨੂੰ ਖਿਲਾਰ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕਰਦਾ ਹੈ